ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਆਓ ਮੋਹਾਲੀ ਵੈੱਲਕਮ ਜੀ ਤੁਹਾਡਾ ਬਹੁਤ ਬਹੁਤ ਦੱਸੋ ਹੁਕਮ ਕਰੋ ਜੀ ਹਾਂਜੀ ਹੈਗਾ ਜੀ ਉਰੇ ਪਾਲ ਢਾਬਾ ਹੈ ਜੀ ਇੱਕ ਉਹਦਾ ਤ ਤੁਹਾਨੂੰ ਵਧੀਆ ਖਾਣਾ ਦਾਣਾ ਹੋਰ ਬਥੇਰੇ ਢਾਬੇ ਨੇ ਪਾਲ ਢਾਬਾ ਹਾਂਜੀ ਬਹੁਤ ਵਧੀਆ ਢਾਬਾ ਹੈ ਜੀ ਉੱਥੇ ਤੁਹਾਨੂੰ ਹਰੇਕ ਚੀਜ਼ ਤਰ੍ਹਾਂ ਦਾ ਭੋਜ ਭੋਜਨ ਪ੍ਰਾਪਤ ਹੋਵੇਗਾ ਨੋਨ ਵੈੱਜ ਵੈੱਜ ਨੋਨ ਵੈੱਜ ਜੋ ਮਰਜ਼ੀ ਲਓ ਜੀ ਤੁਸੀਂ ਹਾਂਜੀ ਹਾਂਜੀ ਆਪਾਂ ਤੁਹਾਨੂੰ ਪੂਰੀ ਗਾਈਡਨੈਸ ਦਉਂਗੇ ਘੁੰਮਾਣੇ ਫਿਰਾਉਣੇ ਵਿਚ ਹੋਰ ਤੁਸੀਂ ਜੋ ਮਰਜ਼ੀ ਜੋ ਹੁਕਮ ਕਰੋਂਗੇ ਜੀ ਅਸੀਂ ਉਹ ਤਿਆਰ ਹੈ ਇ ਇੱਥੇ ਇੱਥੇ ਭੈਣਾਂ ਦਾ ਢਾਬਾ ਹੈਗਾ ਜੀ ਅਤੇ ਇੱਕ ਪਾਲ ਢਾਬਾ ਤੁਹਾਨੂੰ ਦੱਸ ਦਿੱਤਾ ਜੀ ਅਤੇ ਇੱਥੇ ਜੀ ਮਤਲਬ ਬਹੁਤ ਇੱਕ ਤੋਂ ਇੱਕ ਮਸ਼ਹੂਰ ਚੀਜ਼ ਹੋਰ ਕਈ ਜਾਣੀ ਕਿ ਹੈਗੇ ਜੀ ਰੈਸਟਾਰ ਵਧੀਆ

ਤੁਸੀਂ ਆ ਜੋ ਕੋਈ ਨਹੀਂ ਹੈਲੋ ਹੈਲੋ ਹਾਂਜੀ ਮੋਹਾਲੀ ਨਜ਼ਦੀਕ ਪਾਲ ਢਾਬੇ 'ਤੇ ਆ ਜੋ ਤੁਸੀਂ ਪਾਲ ਹਾਂਜੀ ਖਰੜ ਦੇ ਨੇੜੇ ਪਾਲ ਢਾਬੇ 'ਤੇ ਤੁਸੀਂ ਆਓ ਤੁਹਾਨੂੰ ਮੈਂ ਉੱਥੇ ਵਧੀਆ ਤਰੀਕੇ ਨਾਲ ਤੁਹਾਨੂੰ ਮਤਲਬ ਸੇਵਾ ਪਾਣੀ ਕਰੂੰਗੇ ਜੀ ਤੁਹਾਡਾ ਹਾਂਜੀ ਹਾਂ ਕਦੋਂ ਆਉਣਾ ਆਏ ਤੁਸੀਂ ਇਸ ਟਾਈਮ ਆਉਂਗੇ ਜਾਂ ਡਿਨਰ 'ਤੇ ਆਉਂਗੇ ਜੀ ਹੈਲੋ ਹੈਂਜੀ ਹੈਲੋ ਹਾਂਜੀ ਹਾਂਜੀ ਮੈਨੀਊ ਮੈਂ ਤੁਹਾਨੂੰ ਭੇਜ ਦੂੰਗਾ ਕੋਈ ਗੱਲ ਨਹੀਂ ਜੀ ਠੀਕ ਹੈ ਜੀ ਆ ਜਿਓ ਠੀਕ ਹੈ ਜੀ ਕੱਲ੍ਹ ਮਿਲਦੇ ਠੀਕ ਹੈ ਜੀ ਠੀਕ ਓਕੇ ਓਕੇ ਜੀ ਓਕੇ ਠੀਕ ਹੈ ਜੀ ਥੈਂਕ ਯੂ